ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਹਾਂ ਅਤੇ ਮੈਂ ਜ਼ਿਲ੍ਹਾ ਨਿਵਾਸੀ ਪਠਾਨਕੋਟ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਮੇਰੇ ਭਰਾ ਦਾ ਦਸਵੀਂ ਦਾ ਕੱਲ੍ਹ ਸੀ ਬੀ ਐਸ ਈ ਦਾ ਰਿਜ਼ਲਟ ਆਇਆ ਹੈ ਅਤੇ ਉਹ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੈ ਇਸ ਲਈ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਉਸ ਨੂੰ ਅਤੇ ਸਾਰੇ ਪਰਿਵਾਰ ਨੂੰ ਪਾਰਟੀ ਦਿਆਂ ਸਾਰਿਆਂ ਨੂੰ ਮੱਖਣ ਦੇ ਢਾਬੇ ਦਾ ਖਾਣਾ ਬਹੁਤ ਪਸੰਦ ਹੈ ਇਸ ਲਈ ਮੈਂ ਉੱਥੋਂ ਦਾਲ ਮਖਣੀ ਮਟਰ ਪਨੀਰ ਕੜਾਹੀ ਪਨੀਰ ਪਲੇਨ ਰਾਈਸ ਤੰਦੂਰੀ ਰੋਟੀ ਅਤੇ ਮਿੱਠੇ ਵਿੱਚ ਗਾਜਰ ਦਾ ਹਲਵਾ ਔਡਰ ਕਰਨਾ ਚਾਹੁੰਦੀ ਹਾਂ